ਇੱਕੀ ਫਰਵਰੀ ਉੱਨੀ ਸੌ ਨੜਿਨਵੇਂ ਸਤਾਈ ਮਾਰਚ ਉੱਨੀ ਸੌ ਨੜਿਨਵੇਂ ਅੱਠ ਅਗਸਤ ਦੋ ਹਜ਼ਾਰ ਤੇਰ੍ਹਾਂ ਤੇਰ੍ਹਾਂ ਅਗਸਤ ਦੋ ਹਜ਼ਾਰ ਤੇਈ ਦਸ ਦਸੰਬਰ ਦੋ ਹਜ਼ਾਰ ਤੇਈ